ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਮੈਂ ਹੁਸ਼ਿਆਰਪੁਰ ਦੇ ਵਿੱਚ ਨਵੀਂ ਟੂਰਿਸਟ ਆਈ ਆਂ ਤੇ ਮੈਂ ਤੁਹਾਡੇ ਪੁਛਣਾ ਸੀ ਕੀ ਹੁਸ਼ਿਆਰਪੁਰ ਦੇ ਵਿੱਚ ਕੋਈ ਇੱਦਾਂ ਦੀਆਂ ਪ੍ਰਸਿੱਧ ਜਗ੍ਹਾ ਜਗਾਵਾਂ ਹੈਗੀਆਂ ਜਿੱਥੇ ਅਸੀਂ ਘੁੰਮ ਸਕੀਏ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਕਿੱਧਰ ਪੈਂਦਾ ਇਹ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਮੈਂ ਇੱਕ ਜਗ੍ਹਾ ਦਾ ਨਾਮ ਸੁਣਿਆ ਸੀ ਹੁਸ਼ਿਆਰਪੁਰ ਕਹਿੰਦੇ ਸੀ ਨਵੀਂ ਜਗ੍ਹਾ ਖੁੱਲੀ ਆ ਏਜਲ ਫਾਰਮ ਏਜਲ ਫਾਰਮ ਅੱਛਾ ਜੀ ਠੀਕ ਹੈ ਜੀ ਹਾਂਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਦੱਸਣ ਦੇ ਲਈ